ਕੁਛ ਭਾਰਤੀ ਕਲਾ ਸ਼ੈਲੀਆਂ ਹਨ ਜੋ ਅਲੋਪ ਹੋ ਰਹੀਆਂ ਨੇ ਜਿਵੇਂ ਕਿ ਹੱਥ ਦੀ ਕਲਾ ਹੱਥ ਦੀ ਕਲਾ ਅੱਜ ਕੱਲ੍ਹ ਇੰਨੀ ਘੱਟ ਗਈ ਹੈ ਕਿ ਕੋਈ ਵੀ ਹੱਥ ਦੀ ਕਲਾ ਵਾਲੀ ਚੀਜ਼ਾਂ ਲੈਂਦਾ ਹੀ ਨੀਗਾ ਹੱਥ ਦੀ ਕਲਾ ਵਿੱਚ ਕਿੰਨਾ ਕੁਛ ਬਣਦਾ ਹੈ ਲਾਈਕ ਸੂਟਸ ਸੂਈ ਧਾਗੇ ਨਾਲ ਸੀਨਰੀਆਂ ਚੂੜੀਆਂ ਕਿੰਨਾ ਕੁਛ ਬਣਦਾ ਬਟ ਅੱਜ ਕੱਲ੍ਹ ਲੋਕ ਮਸ਼ੀਨਰੀ ਯੁੱਗ ਵਿੱਚ ਜੀ ਰਹੇ ਨੇ ਜਿਸ ਵਿੱਚ ਬਸ ਮਸ਼ੀਨਾਂ ਦਾ ਹੀ ਉਪਯੋਗ ਹੁੰਦਾ ਹੈ ਮਸ਼ੀਨ ਵਾਲੀਆ ਚੀਜ਼ਾਂ ਦੀ ਕੁਆਲਿਟੀ ਇੰਨੀ ਖਰਾਬ ਹੁੰਦੀ ਔਰ ਇੰਨੀਆਂ ਸਸਤੀਆਂ ਹੁੰਦੀਆਂ ਸਗੋਂ ਹੱਥ ਦੀਆਂ ਚੀਜ਼ਾਂ ਦੇ ਪ੍ਰਾਈਜ਼ ਇੰਨੇ ਮਹਿੰਗੇ ਹੁੰਦੇ ਹਨ ਔਰ ਉਹਨਾਂ ਦੀ ਕੁਆਲਟੀ ਇੰਨੀ ਵਧੀਆ ਹੁੰਦੀ ਹੈ ਪਰ ਕੋਈ ਵੀ ਹੱਥ ਦੀਆਂ ਚੀਜ਼ਾਂ ਨਹੀਂ ਲੈਂਦਾ ਮਸ਼ੀਨ ਦੀਆਂ ਹੀ ਚੀਜ਼ਾਂ ਲੈਂਦਾ ਹੈ